ਮੈਂ ਆਪਣੇ ਐਮਾਜ਼ਾਨ ਤੋਂ ਇੱਕ ਕੁੜਤੀ ਮੰਗਵਾਈ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਜਿਹਦੀ ਕਿ ਫਿਟਿੰਗ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਅਤੇ ਉਹਦਾ ਕਲਰ ਅਤੇ ਉਹ ਕੱਪੜਾ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਉਹਦੀ ਲੰਬਾਈ ਵੀ ਉਨੀਂ ਹੀ ਹੈ ਜਿੰਨੀ ਮੈਨੂੰ ਚਾਹੀਦੀ ਸੀ